ਹਾਂ ਜੀ ਸਾਨੂੰ ਖੇਤੀ ਲਈ ਸਰਕਾਰ ਤੋਂ ਬਹੁਤ ਸਾਰੇ ਲਾਭ ਮਿਲਦੇ ਹੀ ਹਨ ਅਤੇ ਨਹੀਂ ਵੀ ਕਣਕ ਦਾ ਰੇਟ ਅਤੇ ਝੋਨੇ ਦਾ ਰੇਟ ਸਰਕਾਰ ਤੈਅ ਕਰਦੀ ਹੈ ਅਤੇ ਉਸ ਉੱਤੇ ਬੋਨਸ ਮਿਲਦਾ ਹੈ ਉਹ ਬੋਨਸ ਸਰਕਾਰ ਘੱਟ ਦਿੰਦੀ ਹੈ ਕਿਸਾਨਾਂ ਦਾ ਫ਼ਸਲ 'ਤੇ ਖ਼ਰਚਾ ਵੱਧ ਹੁੰਦਾ ਹੈ ਇਸ ਲਈ ਕਿਸਾਨ ਕਰਜਈ ਵੀ ਹੋ ਰਹੇ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਪਿਛਾਅ ਲੋਨ ਜਾਂ ਲਿਮਟ ਕਰਵਾਉਂਦਾ ਹੈ ਤਾਂ ਉਹਨਾਂ ਨੂੰ ਘੱਟ ਵਿਆਜ 'ਤੇ ਲੋਨ ਦੇਣਾ ਚਾਹੀਦਾ ਹੈ ਸਬਸਿਡੀ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣਾ ਕਰਜ਼ਾ ਉਤਾਰ ਸਕੇ ਅੱਜ ਕੱਲ੍ਹ ਹੋਰ ਤਾਂ ਬਹੁਤ ਮਹਿੰਗਾਈ ਹੋ ਚੁੱਕੀ ਹੈ ਜਿਵੇਂ ਕਿ ਸਪਰੇਅ ਅਤੇ ਰਸਾਇਣਕ ਖਾਦਾਂ 'ਤੇ ਬਹੁਤ ਜ਼ਿਆਦਾ ਖ਼ਰਚਾ ਹੁੰਦਾ ਹੈ ਪਰ ਸਰਕਾਰ ਫ਼ਸਲ ਦਾ ਉੱਨਾ ਮੁੱਲ ਨਹੀਂ ਮੋੜਦੀ ਕੈਪਟਨ ਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਕਿਸਾਨਾਂ ਨੂੰ ਮਰਨ 'ਤੇ ਮਜ਼ਬੂਰ ਕਰ ਦਿੱਤਾ ਸੀ ਪਰ ਅਸੀਂ ਅੱਜ ਸਰਕਾਰ ਤੋਂ ਇਹ ਚਾਹੁੰਦੇ ਹਾਂ ਕਿ ਜਿਹੜੇ ਪਿਛਲੇ ਕਰਜ਼ੇ ਹਨ ਕਰਜ਼ਿਆਂ ਨੂੰ ਮਾਫ਼ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਾਪਤ ਕੀਤੇ ਜਾਣ ਤਾਂ ਜੋ ਅੱਜ ਕੱਲ੍ਹ ਦੇ ਨੌਜਵਾਨ ਤੋਂ ਅੱਗੇ ਵੱਧਣ ਅਤੇ ਵੱਧ ਤੋਂ ਵੱਧ ਫ਼ਸਲ ਉਗਾਉਣ ਅਤੇ ਖੇਤੀਬਾੜੀ ਵਿੱਚ ਵੱਧ ਤੋਂ ਵੱਧ ਜਾਣ